ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਆਰਤੀ ਮੈਂ ਪਠਾਨਕੋਟ ਤੋਂ ਬੋਲਦੀ ਪਈ ਐਂ ਸਰ ਜੇ ਖੇਤਾਂ ਬਾਰੇ ਦੱਸਿਆ ਜਾਏ ਤਾਂ ਸਾਡੇ ਪੰਜਾਬ ਵਿੱਚ ਬਹੁਤ ਜ਼ਿਆਦਾ ਖੇਤੀਬਾੜੀ ਹੁੰਦੀ ਹੈ ਜਿਸ ਤਰ੍ਹਾਂ ਕਿ ਹਰ ਇਤਿਹਾਸ ਬਾਰੇ ਤੁਹਾਨੂੰ ਮੈਂ ਦੱਸਦੀ ਐ ਜਿਸ ਤਰ੍ਹਾਂ ਕਿ ਖੇਤੀਬਾੜੀ ਕਣਕ ਲਗਾਉਣਾ ਵਾਢੀਆਂ ਕਰਨਾ ਹੋਰ ਵੀ ਬੜੇ ਦੁਆਰਾ ਪ੍ਰਭਾਵਿਤ ਕੀਤਾ ਜਾਂਦਾ ਹੈ ਸ਼ਾਸਕਾਂ ਦੁਆਰਾ ਪ੍ਰਭਾਵਿਤ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਕਿ ਰਾਜਨੀਤੀ ਬਾਰੇ ਦੱਸਿਆ ਜਾਏ ਇਹ ਸਾਡੇ ਦਿੱਲੀ ਤੋਂ ਆ ਕੇ ਰਾਜਨੀਤੀ ਲੜ ਜਾਂਦੇ ਹੈ ਰਣਜੀਤ ਸਿੰਘ ਰਾਜਾ ਬਾਰੇ ਦੱਸਿਆ ਜਾਏ ਰਾਜਾ ਰਣਜੀਤ ਸਿੰਘ ਜੀ ਮਹਾਰਾਜ ਉਨ੍ਹਾਂ ਦੇ ਬਹੁਤ ਜ਼ਿਆਦਾ ਕੀਤੇ ਜਾਂਦੇ ਹੈ ਜਿਸ ਤਰ੍ਹਾਂ ਕਿ ਆਪਣਾ ਖੇਤੀਬਾੜੀ ਦਾ ਕੰਮ ਕੋਈ ਵੀ ਰਾਜਨੀਤੀ ਬਾਹਰੋਂ ਆ ਕੇ ਕਰ ਜਾਂਦਾ ਹੈ ਕਰਕੇ ਚਲਾ ਜਾਂਦਾ ਹੈ ਰਾਜਨੀਤੀ ਜੇ ਕਿਤੇ ਉਹ ਰਾਜਨੀਤੀ ਦੇ ਖੇਤਰਾਂ ਬਾਰੇ ਦੱਸਿਆ ਜਾਏ ਤਾਂ ਜੋ ਸਾਰਾ ਇੱਥੇ ਮਿਲਦਾ ਹੈ ਜਿਸ ਤਰ੍ਹਾਂ ਲੋਕ ਬਹੁਤ ਖੁਸ਼ਹਾਲ ਹੁੰਦੇ ਨੇ ਰਾਜ ਦੇ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਕਿ ਖੇਤਾਂ ਬਾਰੇ ਦੱਸਿਆ ਜਾਂਦਾ ਅਤੇ ਵੱਧ ਤੋਂ ਵੱਧ ਜਿੱਦਾਂ ਕਿ ਆਪਣੇ ਰਾਜਾ ਰਣਜੀਤ ਸਿੰਘ ਹੋ ਉਹ ਵੀ ਆਪਣੇ ਹੀ ਰਾਜ ਦੇ ਰਾਜ ਉਹਨਾਂ ਨੇ ਵੀ ਆਪਣੇ ਉਸਦੇ ਬਾਰੇ ਰਾਜ ਰਾਜ ਰਾਜ ਕੀਤਾ ਹੈ ਨੇਤਾਵਾਂ ਦੇ ਨਾਮ ਦੱਸੇ ਜਾਂਦੇ ਜਿਸ ਤਰ੍ਹਾਂ ਕਿ ਕਈ ਪ੍ਰਸ਼ਾਸਨ ਹੁੰਦੇ ਨੇ ਉਹਨਾਂ ਦਾ ਨਾਂ ਦੱਸਿਆ ਜਾਂਦਾ ਹੈ ਥੈਂਕਿ ਊ ਸਰ